ਚਿੱਤਰਕਾਰੀ ਕਰਦੇ ਸਮੇਂ ਆਮ ਜੋ ਗਲਤੀਆਂ ਹੁੰਦੀਆਂ ਹਨ ਉਹ ਹੈ ਰੰਗਾਂ ਦਾ ਚੁਣਾਵ ਬਹੁਤ ਸਾਰੇ ਹ ਬਹੁਤ ਸਾਰੇ ਲੋਕ ਹਨ ਜੋ ਚੰਗ ਰੰਗਾਂ ਦਾ ਚੁਣਾਵ ਚੰਗੀ ਤਰ੍ਹਾਂ ਨਹੀਂ ਕਰਦੇ ਜਿਸ ਨਾਲ ਉਹਨਾਂ ਦੀ ਚਿੱਤਰਕਾਰੀ ਚੰਗੀ ਤਰ੍ਹਾਂ ਨਹੀਂ ਹੁੰਦੀ ਅਤੇ ਇਹ ਸਭ ਤੋਂ ਹੀ ਬਹੁਤ ਵੱਡੀ ਗਲਤੀ ਹੁੰਦੀ ਹੈ